ਪੰਜਾਬ ਵਿੱਚ ਕਾਰੋਬਾਰੀ ਖੇਤਰ ਉੱਭਰ ਰਹੀਆਂ ਤਕਨੀਕਾਂ ਦਾ ਲਾਭ ਲੈਣਾ ਅਤੇ ਵਰਤੋਂ ਕਰਨਾ ਉਦਯੋਗਾਂ ਨੂੰ ਨਵੇਂ ਮੌਕੇ ਅਤੇ ਖਾਸ ਫਾਇਦੇ ਪ੍ਰਦਾਨ ਕਰਦਾ ਹੈ ਡਿਜੀਟਲਾਈਜ਼ੇਸ਼ਨ ਨਾਲ ਵਪਾਰ ਔਨਲਾਈਨ ਮਾਰਕੀਟਾਂ ਵਿੱਚ ਪਹੁੰਚਦੇ ਹਨ ਜਿਸ ਨਾਲ ਉਨ੍ਹਾਂ ਨੂੰ ਵਧੀਆ ਗਾਹਕ ਪਾਉਣ 'ਚ ਅਤੇ ਵੱਧ ਵਿਕਰੀ ਮਿਲਦੀ ਹੈ ਆਟੋਮੈਸ਼ਨ ਅਤੇ ਰੁਬੋਟਿਕਸ ਦੇ ਜ਼ਰੀਏ ਉਤਪਾਦਨ ਦੀ ਗਤੀ ਅਤੇ ਕੁਆਲਟੀ ਵਿੱਚ ਸੁਧਾਰ ਆਉਂਦਾ ਹੈ ਜਿਸ ਨਾਲ ਲਾਗਤਾਂ ਘੱਟ ਆਉਂਦੀਆ ਹਨ ਡੇਟਾ ਵਿਸ਼ਲੇਸ਼ਣ ਉਨ੍ਹਾਂ ਨੂੰ ਗਾਹਕਾਂ ਦੇ ਰੁਝਾਨਾਂ ਅਤੇ ਮੰਗਾਂ ਨੂੰ ਸਮਝਣ ਵਿੱਚ ਮਦਦ ਕਰਦੀ ਹੈ ਜਿਸ ਨਾਲ ਬਿਹਤਰ ਫੈਸਲੇ ਅਤੇ ਵਧੇਰੇ ਮੁਨਾਫ਼ੇ ਦੀ ਸੰਭਾਵਨਾ ਬਣਦੀ ਹੈ ਨਕਲੀ ਬੁੱਧੀ ਅਤੇ ਵਿੱਤ ਸੰਬੰਧੀ ਖਾਤਾ ਪ੍ਰਣਾਲੀਆਂ ਨਾਲ ਕਾਰੋਬਾਰ ਆਪਣੇ ਖਾਤਿਆਂ ਨੂੰ ਸੁਚੱਜੇ ਤਰੀਕੇ ਨਾਲ ਸ ਪ੍ਰਬੰਧਿਤ ਕਰ ਸਕਦੇ ਹਨ ਅਤੇ ਨਵੇਂ ਸੰਭਾਵਨਾਵਾਂ ਦਾ ਲਾਭ ਉਠਾ ਸਕਦੇ ਹਨ ਇਸ ਤਰ੍ਹਾਂ ਇਹ ਤਕਨੀਕਾਂ ਪੰਜਾਬ ਵਿੱਚ ਕਾਰੋਬਾਰੀ ਖੇਤਰ ਨੂੰ ਕੁੱਲ ਮਿਲਾ ਕੇ ਵਿਕਾਸ ਅਤੇ ਕੁਸ਼ਲਤਾ ਵਿੱਚ ਉੱਚਾ ਕਰਦੀਆਂ ਹਨ